ਹੈਲੋ ਰੈਸਟੋਰੈਂਟ ਤੋਂ ਗੱਲ ਕਰ ਰਹੇ ਹੋ ਜੀ ਸਾਡੇ ਨਾ ਘਰ ਦੇ ਵਿੱਚ ਇੱਕ ਪ੍ਰੋਗਰਾਮ ਹੈ ਜਿਸ ਦੇ ਸੰਬੰਧ ਵਿੱਚ ਅਸੀਂ ਤੁਹਾਡੇ ਰੈਸਟੋਰੈਂਟ ਤੋਂ ਕੋਈ ਸਮਾਨ ਆਰਡਰ ਕਰਨਾ ਚਾਹੁੰਦੇ ਹਾਂ

ਸਮਾਨ ਦੇ ਵਿੱਚ ਆਈਸਕ੍ਰੀਮ ਕੇਕ ਹਲਵਾ ਆਦਿ ਹੋਰ ਵੀ ਮਠਿਆਈ ਦਾ ਸਮਾਨ ਚਾਹੀਦਾ ਹੈ ਸਾਨੂੰ ਮਠਿਆਈ ਸਾਫ਼ ਸੁਥਰੀ ਅਤੇ ਤਾਜ਼ੀ ਚਾਹੀਦੀ ਹੈ ਸਾਨੂੰ ਮਠਿਆਈ ਆਰਡਰ ਦੇ ਮੁਤਾਬਿਕ ਹੀ ਚਾਹੀਦੀ ਹੈ ਅਤੇ ਮਠਿਆਈ ਸਮੇਂ ਸਿਰ ਚਾਹੀਦੀ ਹੈ ਪਾਰਟੀ ਦੇ ਵਿੱਚ ਸਾਰੀ ਮਠਿਆਈ ਸਮੇਂ ਸਿਰ ਪਹੁੰਚਣੀ ਚਾਹੀਦੀ ਹੈ

ਵਧੀਆ ਤਰੀਕੇ ਨਾਲ ਸਾਫ਼ ਸੁਥਰੀ ਪੈਕਿੰਗ ਦੇ ਵਿੱਚ ਚਾਹੀਦੀ ਹੈ